ਅਸੀਂ ਸਿਹਤ ਬੀਮਾ ਕਰਵਾਇਆ ਹੋਇਆ ਜਦੋਂ ਕਦੇ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਅਸੀਂ ਇਸਦੀ ਵਰਤੋਂ ਕਰਦੇ ਹਾਂ ਅਸੀਂ ਸਾਡਾ ਇੱਕ ਬੱਚਾ ਜ਼ਿਆਦਾ ਬਿਮਾਰ ਹੋ ਗਿਆ ਸੀ ਐਮਰਜੈਂਸੀ ਵਿੱਚ ਸਾਨੂੰ ਬਹੁਤ ਪੈਸਿਆਂ ਦੀ ਲੋੜ ਸੀ ਜੋ ਕਿ ਅਸੀਂ ਨਹੀਂ ਕਰ ਸਕਦੇ ਸੀ ਫਿਰ ਅਸੀਂ ਉਹ ਬੀਮਾ ਸਿਹਤ ਵਾਲਾ ਕਾਰਡ ਵਰਤਿਆ ਅਤੇ ਸਾਨੂੰ ਬਹੁਤ ਮਦਦ ਹੋ ਗਈ ਇਸ ਤਰ੍ਹਾਂ ਸਾਡੇ ਬੱਚੇ ਦੀ ਜ਼ਿੰਦਗੀ ਵੀ ਬਚ ਗਈ ਸਾਨੂੰ ਇਹ ਜ਼ਰੂਰ ਕਰਵਾਉਣਾ ਚਾਹੀਦਾ ਹੈ ਇਹ ਕੋਈ ਪਤਾ ਨਹੀਂ ਹੁੰਦਾ ਕਦੋਂ ਕੋਈ ਪ੍ਰੋਬਲਮ ਆ ਜਾਏ ਕਈ ਵਾਰ ਆਪਣੇ ਕੋਲ ਕੋਈ ਇੰਨੀ ਆਰਥਿਕ ਹਾਲਤ ਹੀ ਨਹੀਂ ਹੁੰਦੀ ਵੀ ਆਪਾਂ ਇਲਾਜ ਕਰਵਾ ਸਕੀਏ ਇਸ ਕਰਕੇ ਆਪਣੀ ਜਾਨ ਵੀ ਜਾ ਸਕਦੀ ਹੈ ਕੀਮਤੀ ਜਾਨ ਨੂੰ ਬਚਾਉਣ ਲਈ ਸਾਨੂੰ ਸਿਹਤ ਬੀਮਾ ਜ਼ਰੂਰ ਕਰਵਾਉਣਾ ਚਾਹੀਦਾ